ਇਹ ਸਭ ਤੋਂ ਅਲੱਗ ਭਾਸ਼ਾ ਹੈ ਇਹ ਪੰਜਾਬੀਆਂ ਦੀ ਹਰਮਨ ਪਿਆਰੀ ਬੋਲੀ ਹੈ ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਬਚਪਨ ਤੋਂ ਹੀ ਰਹਿ ਕੇ ਪੰਜਾਬੀ ਆਪਣੀ ਮਾਂ ਤੋਂ ਹੀ ਪੰਜਾਬੀ ਬੋਲੀ ਸਿੱਖਣ ਲੱਗ ਜਾਂਦੇ ਹਨ ਇਹ ਭਾਸ਼ਾ ਸਭ ਤੋਂ ਅਲੱਗ ਭਾਸ਼ਾ ਹੁੰਦੀ ਹੈ ਅਤੇ ਸਾਰਿਆਂ ਨੂੰ ਹੀ ਜਲਦੀ ਸਮਝ ਆ ਜਾਂਦੀ ਹੈ ਸਾਨੂੰ ਪੰਜਾਬੀ ਭਾਸ਼ਾ ਬਹੁਤ ਹੀ ਦਿਲਚਸਪ ਲੱਗਦੀ ਹੈ ਸਾਨੂੰ ਪੰਜਾਬੀ ਉੱਤੇ ਮਾਣ ਹੈ ਕਿਉਂਕਿ ਇਹ ਬਹੁਤ ਹੀ ਸਰਲ ਅਤੇ ਸੌਖੀ ਹੈ ਇਸ ਵਿੱਚ ਸਭ ਤੋਂ ਪਹਿਲਾਂ ਪੈਂਤੀ ਅੱਖਰੀ ਸਿਖਾਈ ਜਾਂਦੀ ਹੈ ਪੰਜਾਬੀ ਭਾਸ਼ਾ ਤੋਂ ਪੰਜਾਬ ਦਾ ਪੰਜਾਬੀ ਸੱਭਿਆਚਾਰ ਉਭਰ ਕੇ ਸਾਹਮਣੇ ਆਉਂਦਾ ਹੈ ਜਦੋਂ ਪੰਜਾਬੀ ਬੋਲੀ ਨੂੰ ਵੀ ਬੋਲਿਆ ਜਾਂਦਾ ਹੈ ਤਾਂ ਇਸ ਵਿੱਚ ਰਸ ਅਤੇ ਮਿਠਾਸ ਪੈਦਾ ਹੁੰਦੀ ਹੈ ਪੰਜਾਬੀ ਭਾਸ਼ਾ ਤੋਂ ਹੀ ਮਾਝੇ ਮਾਲਵੇ ਦੁਆਬੇ ਵਿੱਚ ਰਹਿਣ ਵਾਲੇ ਲੋਕਾਂ ਬਾਰੇ ਪਤਾ ਲੱਗਦਾ ਹੈ ਇਹ ਕਿੱਥੋਂ ਦੇ ਰਹਿਣ ਵਾਲੇ ਹਨ ਵਪਾਰ ਦੇ ਵਣਜ ਵਿੱਚ ਪੰਜਾਬੀ ਭਾਸ਼ਾ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ ਜਦੋਂ ਆੜ੍ਹਤੀਆਂ ਨੂੰ ਜ਼ਿਆਦਾਤਰ ਪੰਜਾਬੀ ਆਉਂਦੀ ਹੈ ਇਸ ਵਪਾਰ ਵਿੱਚ ਹਿਸਾਬ ਕਿਤਾਬ ਵਿੱਚ ਹਿਸਾਬ ਕਿਤਾਬ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਭਾਸ਼ਾ